ਪੇਂਟਿੰਗ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਰੰਗਾਂ ਦੀ ਪਹਿਚਾਣ ਹੋਣਾ ਬਹੁਤ ਜਰੂਰੀ ਹੈ ਪੇਂਟਿੰਗ ਕਰਨ ਲਈ ਲੋੜੀਂਦਾ ਸਮਾਨ ਪੇਂਟ ਬਰੱਸ਼ ਹੋਣਾ ਜਰੂਰੀ ਆ ਅਤੇ ਜਿਸ ਉੱਪਰ ਅਸੀਂ ਪੇਂਟ ਕਰਨਾ ਹੈ ਜਿਵੇਂ ਕੀ ਕੋਈ ਕੱਪੜਾ ਜਾਂ ਕੋਈ ਸ਼ੀਟ ਹੋਣਾ ਵੀ ਬਹੁਤ ਜਰੂਰੀ ਹੈ ਬੱਚੇ ਨੂੰ ਪਹਿਲਾਂ ਪੇਂਟਿੰਗ ਕਰਨ ਤੋਂ ਪਹਿਲਾਂ ਉਸਨੂੰ ਰੰਗਾਂ ਦੀ ਪਹਿਚਾਣ ਕਰਾਉਣੀ ਹੈ ਆਹ ਰੰਗ ਕਿਹੜਾ ਏ ਆਹ ਰੰਗ ਕਿਹੜਾ ਅਤੇ ਇਹਨਾਂ ਰੰਗਾਂ ਨੂੰ ਮਿਲਾਉਣ ਨਾਲ ਕਿਹੜਾ ਰੰਗ ਬਣਦਾ ਹੈ ਇਹਨਾਂ ਦੀ ਪਹਿਚਾਣ ਕਰਾਉਣਾ ਬਹੁਤ ਜਰੂਰੀ ਹੈ ਉਸ ਤੋਂ ਬਾਅਦ ਬਰੱਸ਼ ਦੀ ਵਰਤੋ ਕਿਸ ਤਰ੍ਹਾਂ ਕਰਨੀ ਹੈ ਬਰੱਸ਼ ਨੂੰ ਕਿਸ ਤਰ੍ਹਾਂ ਸਾਫ ਕਰਨਾ ਹੈ ਇਸ ਬਾਰੇ ਸਾਰੀ ਜਾਣਕਾਰੀ ਦੇਣੀ ਬਹੁਤ ਜਰੂਰੀ ਹੈ ਪੇਂਟਿੰਗ ਕਰਨ ਲਈ ਕੋਈ ਵੀ ਕੱਪੜਾ ਅਸੀਂ ਵਰਤ ਸਕਦੇ ਆਂ ਸਸਤੇ ਤੋਂ ਸਸਤਾ ਕੱਪੜਾ ਵਰਤਿਆ ਜਾਵੇ ਕਿਉਂਕਿ ਪੇਂਟ ਸਿੱਖਣ ਤੋਂ ਪਹਿਲਾਂ ਸਾਨੂੰ ਕੋਈ ਪੁਰਾਣਾ ਕੱਪੜੇ ਦਾ ਯੂਜ ਕਰਨਾ ਪੈਂਦਾ ਹੈ ਜਾਂ ਕੋਈ ਪੁਰਾਣੀ ਡਰਾਇੰਗ ਬੁੱਕ ਦਾ ਡਰਾਇੰਗ ਬੁੱਕ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਪੇਂਟਿੰਗ ਦੀ ਪੂਰੀ ਜਾਣਕਾਰੀ ਹੋਣ ਤੋਂ ਬਾਅਦ ਹੀ ਅਸੀਂ ਆਪਣੀ ਪੇਂਟਿੰਗ ਕਰ ਸਕਦੇ ਹਾਂ